ਹਾਂਜੀ ਸੁਮਨ ਮੈਂ ਨਾ ਮਾਨਸਾ ਬਾਰੇ ਜਾਣਨਾ ਚਾਹੁੰਦੀ ਸੀ ਮਾਨਸਾ ਦੇ ਵਿੱਚ ਕੀ ਕੀ ਹੈ ਸਬਜ਼ੀਆਂ ਵਗੈਰਾ ਕਿੱਥੋਂ ਮਿਲਦੀਆਂ ਨੇ ਮਾਰਕਿਟ ਵਗੈਰਾ ਬਾਰੇ ਮੈਂ ਇੱਥੇ ਨਵੀਂ ਆਈ ਹਾਂ ਅੱਛਾ ਅੱਛਾ ਅੱਛਾ ਇੱਕ ਇੱਥੇ ਮਤਲਬ ਕਿ ਮਾਰਕਿਟ ਵਗੈਰਾ ਕਿੱਥੇ ਜਿਹੇ ਹੈ ਮੈਨੂੰ ਦੱਸੋਗੇ ਇਹਦੇ ਬਾਰੇ ਕੁਛ ਅੱਛਾ ਉੱਥੋਂ ਕੀ ਕੀ ਮਿਲਦਾ ਅੱਛਾ ਅੱਛਾ ਇਹ ਸਬਜ਼ੀ ਸਬਜ਼ੀ ਮੰਡੀ ਜਿਹੜੀ ਤੁਸੀਂ ਦੱਸ ਰਹੇ ਸੀ ਕਿਹਦੇ ਨੇੜੇ ਜਿਹੇ ਪੈਂਦੀ ਆ ਬੱਸ ਸਟੈਂਡ ਤੋਂ ਕਿੰਨੀ ਕੁ ਦੂਰ ਹੈ ਅੱਛਾ ਫਾਟਕਾਂ ਦੇ ਕੋਲ ਬਿਲਕੁਲ ਫਾਟਕਾਂ ਦੇ ਕੋਲ ਪੈਂਦੀ ਹੈ ਅੱਛਾ ਅੱਛਾ ਅੱਛਾ ਮਤਲਬ ਕਿ ਸਬਜ਼ੀ ਆਪਾਂ ਜਿਵੇਂ ਮਰਜ਼ੀ ਲੈਣੀ ਹੋਵੇ ਉੱਥੋਂ ਸਾਰੀ ਮਿਲ ਜਾਂਦੀ ਆ ਮਾਰਕਿਟ ਸਬਜ਼ੀ ਮੰਡੀ ਦੇ ਨੇੜੇ ਹੀ ਹੈ ਕਿ ਦੂਰ ਆ ਮਾਰਕਿਟ ਸਬਜ਼ੀ ਮੰਡੀ ਤੋਂ ਅੱਛਾ ਅੱਛਾ ਅੱਛਾ ਅੱਛਾ ਅੱਛਾ ਅੱਛਾ ਹਾਂ ਇਹ ਮਲੇਲੀਅਮ ਸਿਟੀ ਜਿਹੜੀ ਆਪਣੀ ਤੁਸੀਂ ਦੱਸ ਰਹੇ ਸੀ ਹੈ ਨਾ ਇਹ ਇਹ ਤੋਂ ਸਬਜ਼ੀ ਮੰਡੀ ਤੋਂ ਕਿੰਨੀ ਕੁ ਦੂਰ ਪੈ ਜਾਂਦੀ ਹੈ ਅੱਛਾ ਅੱਛਾ ਚਲੋ ਠੀਕ ਹੈ ਫਿਰ ਹੈਂ ਹਾਂ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ